ਛੋਟੇ ਕਾਰੋਬਾਰ ਉਹ ਹੁੰਦੇ ਆ ਜਿਹੜੇ ਕਿ ਅਸੀਂ ਘਰਾਂ ਵਿੱਚ ਕੰਮ ਕਰਦੇ ਹਾਂ ਜਿਸ ਦੇ ਵਿੱਚ ਅਸੀਂ ਕੋਈ ਇੰਪਲੋਇ ਨਹੀਂ ਹੁੰਦੇ ਕੁਛ ਨਹੀਂ ਹੁੰਦੇ ਅਸੀਂ ਖੁਦ ਕੰਮ ਕਰਦੇ ਹਾਂ ਛੋਟੇ ਕੰਮ ਹੁੰਦੇ ਆ ਉਹ ਜਿਵੇਂ ਕਿ ਅਸੀਂ ਘਰ ਵਿੱਚ ਟੀਫਨ ਸਿਸਟਮ ਸ਼ੁਰੂ ਕਰਦੇ ਹਾਂ ਉਹ ਛੋਟੇ ਕੰਮ ਹੁੰਦੇ ਹੈ ਜਿਵੇਂ ਕਿ ਘਰ ਟਿਊਸ਼ਨਸ ਕਰਵਾਉਂਦੇ ਹਾਂ ਉਹ ਛੋਟੇ ਕਾਰੋਬਾਰ ਹੋ ਗਏ ਮਤਲਬ ਜਿਸ ਕੰਮ ਲਈ ਸਾਨੂੰ ਬਾਹਰ ਨਾ ਜਾਣਾ ਪਵੇ ਅਸੀਂ ਘਰ ਵੀ ਕਰ ਸਕਦੇ ਹਾਂ ਉਹ ਛੋਟੇ ਕਾਰੋਬਾਰ ਹੁੰਦੇ ਹੈ ਮੇਰਾ ਕਾਰੋਬਾਰ ਵਿੱਚ ਦਿਲਚਸਪ ਹੈ ਉਹ ਹੈ ਟਿਊਸ਼ਨ ਟਿਊਸ਼ਨਸ ਕਰਵਾ ਰਹੀ ਹਾਂ ਘਰ ਘਰ ਬੈਠ ਕੇ ਆਪਾਂ ਟਿਊਸ਼ਨਸ ਕਰਵਾਉਂਦੇ ਹਾਂ ਆਪਣਾ ਇੰਟ੍ਰਸਟ ਉਹਦੇ 'ਚ ਤਾਂ ਹੀ ਹੋਵੇਗਾ ਦਿਲਚਸਪੀ ਤਾਂ ਹੀ ਹੋਵੇਗੀ ਜੇ ਆਪਣਾ ਖੁਦ ਉਸ ਚੀਜ਼ ਵੱਲ ਧਿਆਨ ਹੋਵੇਗਾ ਹੁਣ ਮੇਰਾ ਧਿਆਨ ਟਿਊਸ਼ਨਸ ਵਿੱਚ ਹੈ ਇਸ ਲਈ ਮੈਂ ਘਰ ਵਿੱਚ ਟਿਊਸ਼ਨਸ ਕਰਵਾਉਂਦੀ ਹਾਂ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਪੜ੍ਹਾਉਣ ਦਾ ਸ਼ੋਂਕ ਹੈ ਤਾਂ ਕਿ ਮੇਰੇ ਇਹ ਸੁਪਨੇ ਵੀ ਹੈ ਕਿ ਮੈਂ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਵਾਂ ਜਿਸ ਦੇ ਨਾਲ ਕਿ ਉਨ੍ਹਾਂ ਦਾ ਫਿਊਚਰ ਜਿਹੜਾ ਕਿ ਵਧੀਆ ਹੋਵੇ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਚੀਜ਼ਾਂ ਦੱਸਾਂ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਲਈ ਮੇਰਾ ਦਿਲ ਮੇਰੀ ਦਿਲਚਸਪੀ ਟਿਊਸ਼ਨਸ ਵਿੱਚ ਹੈ ਹੋਰ ਵੀ ਬਹੁਤ ਛੋਟੇ ਛੋਟੇ ਕੰਮ ਹੁੰਦੇ ਜਿਹੜੇ ਆਪਾਂ ਘਰ ਬੈਠ ਕੇ ਕਰ ਸਕਦੇ ਹਾਂ ਸਾਨੂੰ ਛੋਟੇ ਕੰਮ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਕੋਈ ਛੋਟੇ ਕਾਰੋਬਾਰ ਛੋਟੇ ਨਹੀਂ ਹੁੰਦੇ ਤਾਂ ਸਾਨੂੰ ਮਤਲਬ ਛੋਟੇ ਛੋਟੇ ਕੰਮਾਂ ਵਿੱਚੋਂ ਵੀ ਵਧੀਆ ਪੈਸੇ ਕਮਾ ਸਕਦੇ ਹਾਂ ਬੱਟ ਪੈਸੇ ਅਸੀਂ ਤਾਂ ਕਮਾ ਸਕਦੇ ਹਾਂ ਜੇ ਆਪਣੀ ਉਹਦੇ ਵਿੱਚ ਦਿਲਚਸਪੀ ਹੁੰਦੀ ਹੈ ਦਿਲਚਸਪੀ ਆਪਣੀ ਤਾਂ ਹੁੰਦੀ ਹੈ ਜੇ ਆਪਾਂ ਸ਼ੁਰੂ ਤੋਂ ਹੀ ਉਹ ਚੀਜ਼ ਬਾਰੇ ਸੋਚਿਆ ਹੋਵੇ